ਮਤਲਬ ਅੱਜਕੱਲ ਜਿਵੇਂ ਨਾ ਅੱਜ ਕੱਲ ਤੇ ਨੌਜਵਾਨਾਂ ਵਿੱਚ ਫੋਰਨ ਜਾਣ ਦਾ ਰੁਜਾਨ ਬਹੁਤ ਵੱਧ ਰਿਹਾ ਹੈਨਾ ਜਿਵੇਂ ਹੁਣ ਕੋਈ ਵੀ ਬੱਚਾ ਜਾਂ ਕੋਈ ਵੀ ਨੌਜਵਾਨ ਪੰਜਾਬੀ ਭਾਸ਼ਾ ਵਿੱਚ ਗੱਲ ਕਰਦਾ ਤਾਂ ਉਹਨੂੰ ਥੋੜਾ ਬੈਕਵਰਡ ਸਮਝਿਆ ਜਾਂਦਾ ਉਹਨਾਂ ਨੂੰ ਹੀਨ ਭਾਵਨਾ ਨਾਲ ਦੇਖਿਆ ਜਾਂਦਾ ਜਿਹੜਾ ਬੰਦਾ ਅੰਗਰੇਜ਼ੀ ਬੋਲਦਾ ਭਾਵੇਂ ਤੁਹਾਡੇ ਬਹੁਤੀ ਬੋਲਦਾ ਹੋਵੇ ਹਨਾ ਉਹਨੂੰ ਭਾਵੇਂ ਕੁਝ ਆਉਂਦਾ ਨਹੀਂ ਆਉਂਦਾ ਉਹ ਕੋਈ ਮੈਟਰ ਨਹੀਂ ਕਰਦਾ ਹਨਾ ਉਹਨੂੰ ਬਸ ਮਾਡਰਨ ਸਮਝਿਆ ਜਾਂਦਾ ਜੇ ਕੋਈ ਬੰਦਾ ਪੰਜਾਬੀ ਬੋਲਦਾ ਆਪਣੀ ਪੰਜਾਬੀ ਮਾਤ ਭਾਸ਼ਾ ਨੂੰ ਮਤਲਬ ਕਿ ਪ੍ਰਮੋਟ ਕਰਦਾ ਤਾਂ ਉਹਨੂੰ ਕੀ ਮਤਲਬ ਓਕੇ ਇੱਕ ਬੈਕਵਰਡ ਜੇ ਏਰੀਏ ਨਾਲ ਸਮਝਿਆ ਜਾਂਦਾ ਲੋਕ ਆਪਣੇ ਮਾਂ ਬੋਲੀ ਤੋਂ ਦੂਰ ਹੋ ਰਹੇ ਨੇ ਹਨਾ ਕਿਉਂਕਿ ਬਹੁਤ ਗਲਤ ਗੱਲ ਹ ਅੱਜ ਕੱਲ ਮਤਲਬ ਤੇ ਦੂਜੀਆਂ ਇੰਗਲਿਸ਼ ਜਾਂ ਹਿੰਦੀ ਭਾਸ਼ਾਵਾਂ ਵਾਲੇ ਜਿਆਦਾ ਰੁਝਾਨ ਵੱਧ ਰਿਹਾ ਲੋਕਾਂ ਦਾ ਕਿਉਂਕਿ ਗਲਤ ਹੈ ਮਤਲਬ ਆਪਣੀ ਮਾਤਭਾਸ਼ਾ ਨੂੰ ਵੀ ਪ੍ਰਮੋਟ ਕਰਨਾ ਚਾਹੀਦਾ